ਅਸੀਂ ਕਈ ਕਿਸਮ ਦੇ ਪੌਦੇ ਲਗਾਉਂਦੇ ਹਾਂ ਜਿਵੇਂ ਕਿ ਮੈਡੀਸ਼ਨਲ ਪੌਦੇ ਹੋ ਪਲਾਂਟ ਹੋ ਗਏ ਜਿਵੇਂ ਐਲੋ ਵੀਰਾ ਹੋ ਗਿਆ ਅਤੇ ਕੜ੍ਹੀ ਪੱਤਾ ਹੋ ਗਿਆ ਪੁਦੀਨਾ ਧਨੀਆ ਅਤੇ ਇੱਕ ਸ਼ਾਂਤੀ ਦਾ ਪੌਦਾ ਹੋ ਗਿਆ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਪੌਦੇ ਲਗਾਏ ਹੋਏ ਹਨ